ਭਾਰਤ ਵਿੱਚ ਪ੍ਰਾਚੀਨ ਅਤੇ ਮੱਧਕਾਲੀ ਦੌਰ ਵਿੱਚ ਸਾਡੇ ਬਹੁਤ ਸਾਰੇ ਰਾਜਿਆਂ ਬਾਰੇ ਕਿੱਸੇ ਸੁਣੇ ਸੁਣੇ ਸੁਣਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਉਹਨਾਂ ਦੀ ਉਮਰ ਉਹਨਾਂ ਦੇ ਰਾਜ ਸ ਰਾ ਉਹਨਾਂ ਦਾ ਜਨਮ ਨਵੰਬਰ ਤੇਰ੍ਹਾਂ ਸਤਾਰ੍ਹਾਂ ਸੌ ਅੱਸੀ 'ਚ ਹੋਇਆ ਅਤੇ ਉਹਨਾਂ ਦੀ ਆਪਣੇ ਰਾਜ ਭਾਗ ਸੰਭਾਲਣ ਸਮੇਂ ਉਮਰ ਵੀਹ ਸਾਲ ਦੀ ਸੀ ਅਤੇ ਉਹਨਾਂ ਦਾ ਰਾਜ ਅਠਾਰ੍ਹਾਂ ਸੌ ਇੱਕ ਤੋਂ ਲੈ ਕੇ ਅਠਾਰ੍ਹਾਂ ਸੌ ਉਨਤਾਲੀ ਤੱਕ ਯਾਨੀ ਕਿ ਚਾਲੀ ਸਾਲ ਤੱਕ ਰਿਹਾ ਉਹਨਾਂ ਦਾ ਰਾਜ ਇੰਨਾ ਕੁ ਜ਼ਿਆਦਾ ਵਧੀਆ ਸੀ ਕਿ ਕੋਈ ਉਸ ਸਮੇਂ ਭੁੱਖਾ ਨਹੀਂ ਸੀ ਸੌਂਦਾ ਹਰ ਤਰ੍ਹਾਂ ਦੇ ਹਰ ਵਰਗ ਦੇ ਬੰਦੇ ਨੂੰ ਖਾਣਾ ਦਿੱਤਾ ਜਾਂਦਾ ਸੀ ਅਤੇ ਇਨਸਾਫ ਤਰੀਕਾ ਇਨਸਾਫ ਪ੍ਰਣਾਲੀ ਇੰਨੀ ਕੁ ਜ਼ਿਆਦਾ ਚੰਗੀ ਸੀ ਕਿ ਹਰ ਬੰਦੇ ਨੂੰ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਜਾਂ ਕਿਸੇ ਵੀ ਧਰਮ ਦਾ ਹੋਵੇ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਂਦਾ ਸੀ ਜਿਸ ਦੀ ਹਰ ਪਾਸੇ ਚ ਪ੍ਰਸ਼ੰਸਾ ਹੁੰਦੀ ਸੀ ਅਤੇ ਹਰ ਤਰ੍ਹਾਂ ਦੇ ਵਰਗ ਉਸ ਸਮੇਂ ਖੁਸ਼ ਰਹਿੰ ਖੁਸ਼ ਰਹਿੰਦਾ ਸੀ ਅਤੇ ਉਹ ਇੱਕ ਚੰਗੇ ਸ਼ਾਸਕ ਵਜੋਂ ਵੀ ਮਸ਼ਹੂਰ ਸਨ ਉਹਨਾਂ ਨੇ ਕਦੇ ਵੀ ਕਿਸੇ ਨਿਹੱਥੇ ਬੰਦੇ 'ਤੇ ਵਾਰ ਨਹੀਂ ਕੀਤਾ ਕਿਸੇ ਗਰੀਬ ਮਜਲੂਮ 'ਤੇ ਵਾਰ ਨਹੀਂ ਕੀਤਾ ਕਿਸੇ ਬਿਨਾ ਮਜ ਕਿਸੇ ਬਿਨਾ ਗਲਤੀ ਤੋਂ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਅਤੇ ਉਹਨਾਂ ਦਾ ਇੱਕ ਚੰਗਾ ਗੁਣ ਇਹ ਵੀ ਸੀ ਕਿ ਉਹ ਹਰ ਇੱਕ ਤਰ੍ਹਾਂ ਦੇ ਧਰਮਾਂ ਦਾ ਸਤਿਕਾਰ ਕਰਦੇ ਸਨ ਸਾਰੇ ਜਿੰਨੇ ਵੀ ਵਰਗ ਉਸ ਸਮੇਂ ਉਹਨਾਂ ਦੇ ਰਾਜ ਭਾਗ ਵਿੱਚ ਮ ਮੌਜੂਦ ਸਨ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ ਉਹਨਾਂ ਨੇ ਹਰੇਕ ਵਰਗ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਅਤੇ ਉਹਨਾਂ ਨੇ ਹ ਆਪਣੇ ਰਾਜ ਭਾਗ ਵਿੱਚ ਕਦੇ ਵੀ ਨਿਹੱਥੇ 'ਤੇ ਵਾਰ ਨਹੀਂ ਕੀਤਾ ਇਨਸਾਫ ਪ੍ਰਣਾਲੀ ਇੰਨੀ ਕੁ ਵਧੀਆ ਸੀ ਕਿ ਉਹਨਾਂ ਦੇ ਸਮੇਂ ਇੱਕ ਉਸ ਉਹਨਾਂ ਦਾ ਰਾਜ ਭਾਗ ਦੇ ਸਮੇਂ ਉਹਨਾਂ ਦੀ ਅੰਗਰੇਜ਼ਾਂ ਨਾਲ ਇੱਕ ਸੰਧੀ ਹੋਈ ਸੀ ਜੋ ਸਤਲੁਜ ਕਿਨਾਰੇ ਦੇ ਹੋਈ ਸੀ ਉਸ ਸੰਧੀ ਦੇ ਵਿੱਚ ਇਹਨਾਂ ਦਾ ਇਹ ਫੈਸਲਾ ਹੋਇਆ ਇਹ ਸੰਧੀ ਹੋਈ ਸੀ ਕਿ ਦੋਵਾਂ ਧਿਰਾਂ ਦੇ ਕੋਈ ਅੰ ਬਾ ਆਪਣੇ ਬੰਨ ਬੰਨਾ ਨਹੀਂ ਟੱਪਿਆ ਜਾਵੇਗਾ ਹੱਦਾਂ ਦੇ ਤੱਕ ਬੰਦ ਕਰ ਦਿੱਤਾ ਸੀ ਜ ਉਹਨਾਂ ਨੂੰ ਉਹਨਾਂ ਦੇ ਰਾਜ ਭਾਗ ਵਿੱਚ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਅੰਗਰੇਜ਼ ਉਹਨਾਂ ਦੀਆਂ ਹੱਦਾਂ ਟੱਪ ਕੇ ਆਏ ਹੋਣ ਪਰ ਮਹਾਰਾਜਾ ਰਣਜੀਤ ਸਿੰਘ ਜੀ ਕਈ ਵਾਰ ਕੰਮ ਨੂੰ ਲੈ ਕੇ ਉਹਨਾਂ ਦੀਆਂ ਹੱਦਾਂ ਤੱਕ ਜਾਣ ਤਾਂ ਉਹਨਾਂ ਦਾ ਹੱਦਾਂ ਜਿੰਨਾ ਮਤਲਬ ਉਸ ਸਮੇਂ ਰਾਜ ਸੀ ਉਹਨਾਂ ਦੇ ਕ ਦਿੱਲੀ ਤੋਂ ਖੈਬਰ ਤੱਕ ਦਾ ਰਾਜ ਸੀ ਅਤੇ ਕਾਫੀ ਜ਼ਿਆਦਾ ਮਤਲਬ ਏਰੀਆ ਵਾਈਡ ਸੀ ਉਸ ਸਮੇਂ ਅਤੇ ਜਿੰਨਾ ਵੀ ਉਹਨਾਂ ਦਾ ਰਾਜ ਸੀ ਕੋਈ ਵੀ ਦੁਸ਼ਮਣ ਹੱਦਾਂ ਦੇ ਨੇੜਿਓਂ ਜ ਜਲਦੀ ਤੋਂ ਜਲਦੀ ਉਨ੍ਹਾਂ ਤੱਕ ਦੂਰ ਹੋ ਕੇ ਲੰਘਦਾ ਸੀ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਾਸਕ ਐਨੇ ਕੁ ਜ਼ਿਆਦਾ ਵਧੀਆ ਸੀ ਕਿ ਕਿਸੇ ਤੋਂ ਡਰਦੇ ਨਹੀਂ ਸਨ ਵਧੀਆ ਫੌਜ ਸੀ ਉਹਨਾਂ ਦੀ ਕਾਫੀ ਜ਼ਿਆਦਾ ਗਿਣਤੀ 'ਚ ਫੌਜੀ ਸਨ ਅਤੇ ਉਹਨਾਂ ਦਾ ਸ ਅਖੀਰ ਵਿੱਚ ਅਠਾਰ੍ਹਾਂ ਸੌ ਉਨਤਾਲੀ ਵਿੱਚ ਗੰਭੀਰ ਬਿਮਾਰੀ ਨਾਲ ਦਿਹਾਂਤ ਹੋ ਗਿਆ ਹੈ ਅਤੇ ਅੱਜ ਵੀ ਗੱਲਾਂ ਇਹ ਸੁਣਨ ਵਿੱਚ ਆਉਂਦੀਆਂ ਹਨ ਕਿ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਵਿੱਚ ਹੋਇਆ ਹੈ ਉਹ ਹੁਣ ਤੱਕ ਦੁਨੀਆ 'ਤੇ ਕਿਤੇ ਵੀ ਨਹੀਂ ਇਹਨਾ ਚੰਗਾ ਕਿਤੇ ਵੀ ਨਹੀਂ ਹੋਇਆ